ਭਾਰਤੀ ਦੀਆਂ ਸਭ ਤੋਂ ਪ੍ਰਸਿੱਧ ਖੇਡਾਂ ਹਨ ਬੈਡਮਿੰਟਨ ਟੈਨਿਸ ਕ੍ਰਿਕੇਟ ਖੋ ਖੋ ਫੁੱਟਬੋਲ ਅਤੇ ਮਸ਼ਹੂ ਮਸ਼ਹੂਰ ਐਥਲੀਟ ਜਿਹੜੇ ਹਨ ਉਹ ਹੈ ਵਿਰਾਟ ਕੋਹਲੀ ਸਚਿਨ ਤੇਂਨਦੁਲਕਰ ਐਂਡ ਸਾਨੀਆ ਮਿਰਜ਼ਾ